ਹਾਲ ਹੀ ਦੇ ਸਾਲਾਂ ਵਿੱਚ ਸੈਰ ਸਪਾਟਾ ਕਾਫੀ ਵਧਿਆ ਵੀ ਹੈ ਅਤੇ ਘਟਿਆ ਵੀ ਹੈ ਜਦੋਂ ਪਹਿਲਾਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ ਤਾਂ ਸੈਰ ਸਪਾਟੇ ਵਿੱਚ ਘਾਟਾ ਹੋਇਆ ਸੀ ਲੋਕ ਘੁੰਮਣ ਫਿਰਨ ਨਹੀਂ ਸੀ ਜਾ ਰਹੇ ਕਿਉਂਕਿ ਲੋਕਡਾਊਨ ਲੱਗਿਆ ਹੋਇਆ ਸੀ ਅਤੇ ਬਾਹਰ ਜਾਣਾ ਕੁਛ ਸੁਰੱਖਿਅਤ ਨਹੀਂ ਸੀ ਅਤੇ ਹੁਣ ਜਦੋਂ ਕਰੋਨਾ ਦਾ ਟੈ ਸਾਈ ਸਮੇਂ ਖ਼ਤਮ ਹੋ ਗਿਆ ਹੈ ਤਾਂ ਹੁਣ ਸੈਰ ਸਪਾਟੇ ਵਿੱਚ ਕਾਫੀ ਵਾਧਾ ਹੋ ਗਿਆ ਅਤੇ ਲੋਕ ਘੁੰਮਣ ਫਿਰਨ ਲਈ ਜਾਂਦੇ ਹਨ ਘੁੰਮਣ ਫਿਰਨ ਨਾਲ ਸਾਨੂੰ ਵਾਤਾਵਰਣ ਦਾ ਪਤਾ ਲੱਗਦਾ ਹੈ ਅਤੇ ਵੱਖ ਵੱਖ ਸੰਸਕ੍ਰੀਤਿਆਂ ਅਤੇ ਧਰਮਾਂ ਦੇ ਬਾਰੇ ਪਤਾ ਲਗਦਾ ਹੈ ਸਾਨੂੰ ਘੁੰਮਣ ਲਈ ਹਮੇਸ਼ਾ ਜਾਣਾ ਹੀ ਚਾਹੀਦਾ ਅਤੇ ਉੱਥੇ ਜਾ ਕੇ ਸਾਨੂੰ ਭਾਈਚਾਰੇ ਦੀ ਭਾਵਨਾ ਨੂੰ ਵੀ ਵਧਾਉਣਾ ਚਾਹੀਦਾ ਹੈ ਭਾਈਚਾਰੇ ਦੀ ਭਾਵਨਾ ਵਧਾਉਣ ਨਾਲ ਸਾਡਾ ਆਪਸੀ ਮੇਲ ਜੋਲ ਵਧਦਾ ਹੈ ਅਤੇ ਸਾਨੂੰ ਵੱਖਰੀ ਵੱਖਰੀ ਸੰਸਕ੍ਰਿਤੀਆਂ ਅਤੇ ਖਾਣਾ ਪੀਣਾ ਵਗੈਰਾ ਸਾਰਿਆਂ ਬਾਰੇ ਪਤਾ ਲੱਗਦਾ ਸਾਨੂੰ ਹਮੇਸ਼ਾ ਭਾਈਚਾਰੇ ਦੀ ਭਾਵਨਾ ਵਧਾਉਣੀ ਚਾਹੀਦੀ ਆ ਅਗਲੇ ਬੰਦਿਆਂ ਨਾਲ ਤਾਂ ਕਿ ਉਹਨਾਂ ਨੂੰ ਵੀ ਵਧੀਆ ਲੱਗੇ ਉਹਨਾਂ ਦੇ ਵਿੱਚ ਵੀ ਭਾਈਚਾਰੇ ਦੀ ਭਾਵਨਾ ਵਧੇ